ਮੈਨੂੰ ਬਾਇਕ ਚਲਾਉਣਾ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਬਾਇਕ ਲੈਣ ਲਈ ਆਪਣੇ ਕੋਲ ਬਹੁਤ ਪੈਸੇ ਇਕੱਠੇ ਕਰ ਰਹਾ ਹਾਂ ਅਤੇ ਪੈਸੇ ਇਕੱਠੇ ਹੋਣ ਤੋਂ ਬਾਅਦ ਮੈਂ ਇੱਕ ਬਾਈਕ ਲਵਾਂਗਾ ਅਤੇ ਬਾਇਕ ਲੈ ਕੇ ਸਭ ਤੋਂ ਪਹਿਲਾਂ ਮੈਂ ਹਜੂਰ ਸਾਹਿਬ ਜਾਵਾਂਗਾ ਉੱਥੇ ਜਾ ਕੇ ਮੱਥਾ ਟੇਕਾਂਗਾ ਅਤੇ ਇਸ ਤੋਂ ਬਾਅਦ ਮੈਂ ਬਾਇਕ ਲੈ ਕੇ ਆਪਣੇ ਦੋਸਤਾਂ ਨਾਲ ਪਹਾੜਾ ਵੱਲ ਘੁੰਮਣ ਜਾਵਾਂਗਾ ਅਤੇ ਉੱਥੇ ਅਸੀਂ ਬਹੁਤ ਜ਼ਿਆਦਾ ਮਸਤੀ ਕਰਾਂਗੇ ਅਤੇ ਮੈਨੂੰ ਪਹਾੜਾਂ ਉੱਪਰ ਬਾਇਕ ਚਲਾਉਣੀ ਬਹੁਤ ਜ਼ਿਆਦਾ ਚੰਗੀ ਲੱਗਦੀ ਹੈ ਉੱਥੇ ਮੈਂ ਬਾਇਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਣਾ ਚਲਾਵਾਂਗਾ ਅਤੇ ਉੱਥੇ ਦੀਆਂ ਸੜਕਾਂ ਦਾ ਆਨੰਦ ਲਵਾਂਗਾ ਬਾਇਕ ਚਲਾ ਕੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ